ਮੈਂ ਕਿਤਾਬ ਪੜ੍ਹੀ ਸੀ ਇੱਕ ਜੇਰਾ ਤੁਹਾਨੂੰ ਦੱਸਿਆ ਵੀ ਹੈ ਜਿਵੇਂ ਕਿ ਪਹਿਲਾਂ ਆਪਾਂ ਵੀ ਜਸਵੰਤ ਸਿੰਘ ਕੰਵਲ ਉਹਨਾਂ ਦੀਆਂ ਨਾਵਲਾਂ ਨੇ ਅਤੇ ਉਹਨਾਂ ਦੇ ਵਿੱਚ ਇੱਕ ਨਾਵਲ ਉਹਨਾਂ ਦੀ ਜੇਰਾ ਬਹੁਤ ਛੋਟੀ ਜਿਹੀ ਆ ਪਰ ਬਹੁਤ ਦਿਲਚਸਪ ਹੈ ਉਹ ਉਹਨੂੰ ਪੜ੍ਹਦੇ ਪੜ੍ਹਦੇ ਬਹੁਤ ਜਗ੍ਹਾ ਹਾਸੀ ਆਉਂਦੀ ਹੈ ਕਿ ਜਿਵੇਂ ਕਿ ਉਹ ਦਿਓਰ ਭਰਜਾਈ ਦੇ ਰਿਸ਼ਤੇ ਦੇ ਬਾਰੇ ਜਾਂ ਕੁਝ ਹੈ ਨਾ ਅਤੇ ਉਹ ਬਸ ਇਹੀ ਹੈ ਕਿ ਵੀ ਉਹਦੇ ਵਿੱਚ ਜਿਵੇਂ ਕਿ ਉਹਦੀ ਜਿਹੜੀ ਹਰਿੰਦਰ ਭਾਬੀ ਹੁੰਦੀ ਹੈ ਉਹ ਵਿਆਹ ਕੇ ਆਈ ਹੁੰਦੀ ਉਹਦੇ ਵੱਡੇ ਭਰਾ ਨੂੰ ਪਰ ਉਹਨਾਂ ਦੀ ਆਪਸ ਦੇ ਵਿੱਚ ਨਾ ਬਣਨੀ ਜਿਹਦੇ ਕਰਕੇ ਮਤਲਬ ਉਹਨਾਂ ਦੇ ਕੋਈ ਆਪਸੀ ਜਿਹੜੇ ਸੀਗੇ ਰਿਲੇਸ਼ਨ ਚੰਗੇ ਨਹੀਂ ਬਣੇ ਅਤੇ ਫਿਰ ਇਸ ਕਰਕੇ ਉਹਦੇ ਦਿਓਰ ਅਤੇ ਭਾਬੀ ਦੀਆਂ ਜਿਹੜੀਆਂ ਵਿੱਚ ਵਿੱਚ ਜਿਹੜੀਆਂ ਹੈਗੀਆਂ ਨੇ ਜਿਵੇਂ ਉਹਨੂੰ ਪੇਕਿਆਂ ਤੋਂ ਲੈ ਕੇ ਆਉਂਦਾ ਤਾਂ ਉਹ ਵਿੱਚ ਵਿੱਚ ਚੁਟਕਲੇ ਟਾਈਪ ਮਤਲਬ ਐਂ ਲਾ ਲਓ ਕਿ ਇੱਕ ਦੂਜੇ ਨੂੰ ਜਿਹੜੇ ਤਾਨੇ ਤਾਂਜੇ ਜਿੱਦਾਂ ਇੱਕ ਦੂਜੇ ਦੇ ਸਾਹਮਣੇ ਕਰਦੇ ਨੇ ਬਾਕੀਆਂ ਦੇ ਟੱਬਰ ਦੇ ਸਾਹਮਣੇ ਤਾਂ ਉਹ ਕੁਛ ਇੰਟਰਸਟਿੰਗ ਜੇ ਲੱਗਦੇ ਨੇ ਠੀਕ ਹੈ ਅਤੇ ਉਹਨਾਂ ਕਾਰਨ ਉਹਨਾਂ ਨੂੰ ਪੜ੍ਹਦੇ ਹੋਏ ਬਹੁਤ ਹਾਸੀ ਆਈ ਸੀਗੀ ਬਸ ਮੇਰੇ ਵੱਲੋਂ ਤਾਂ ਇਹੀ ਲੱਗਦਾ ਕਿ ਵੀ ਹੋਰ ਮੈਂ ਬਾਕੀ ਜ਼ਿਆਦਾਤਰ ਕੰਟੈਂਟ ਜਿਹੜਾ ਹੈਗਾ ਥੋੜ੍ਹਾ ਜਿਹਾ ਸੰਸੀਅਰ ਮੈਂ ਲਾ ਲਓ ਕਿ ਵੀ ਥੋੜ੍ਹਾ ਜਿਹਾ ਸੰਜੀਦਾ ਜਾਂ ਚੱਕਦਾ ਅਤੇ ਹਾਸੀ ਮਜ਼ਾਕ ਵਾਲਾ ਘੱਟ ਪਸੰਦ ਹੈ ਅਤੇ ਵਧੀਆ ਜਿਹੜਾ ਇੰਟਰਸਟਿੰਗ ਅਤੇ ਥੋੜ੍ਹਾ ਜਿਹਾ ਦਿਮਾਗ਼ੀ ਤੌਰ 'ਤੇ ਥੋੜ੍ਹਾ ਜਿਹਾ ਨਾ ਵਿਕਾਸ ਕਰੇ ਜਾਂ ਵੀ ਨੌਲੇਜ ਵੱਧ ਦੇਵੇ ਉਹਨਾਂ ਚੀਜ਼ਾਂ ਵੱਲ ਧਿਆਨ ਵੱਧ ਹੈ ਹਾਸੀ ਮਜ਼ਾਕ ਵਾਲੇ ਕੰਟੈਂਟ ਮੈਂ ਘੱਟ ਪੜ੍ਹਦਾਂ